ਮੈਂ ਔਨਲਾਈਨ ਇੱਕ ਮੋਬਾਇਲ ਮੰਗਵਾਇਆ ਜਿਹੜਾ ਕਿ ਰੈੱਡਮੀ ਬਾਰਾਂ ਨੋਟ ਦਾ ਸੀ ਉਹ ਇੰਨਾ ਵਧੀਆ ਸੀ ਉਹਦੇ ਵਿੱਚ ਮੈਬਰੀ ਜਿਹੜੀ ਸੀ ਇਕ ਇੱਕ ਸੌ ਅਠਾਈ ਜੀ ਪੀ ਸੀ ਔਰ ਉਹਦਾ ਇੰਟਰਨਲ ਮੈਬਰੀ ਜਿਹੜੀ ਸੀ ਉਹ ਚੌਂਹਠ ਜੀ ਪੀ ਸੀ ਉਸਦਾ ਬੈਕਅੱਪ ਜਿਹੜਾ ਪਿਕਸਲ ਸੀ ਉਹ ਪੰਜ ਪੰਜ ਹਜ਼ਾਰ ਮੈਗਾ ਪੀ ਸੀ ਸੀ ਅਤੇ ਉਹਦੀ ਰੈਮ ਜਿਹੜੀ ਸੀ ਸਿਕਸ ਪੁਆਇੰਟ ਫਿਫਟੀ ਸੀ ਔਰ ਉਹਦਾ ਬੈਕ ਕੈਮਰਾ ਬਹੁਤ ਵਧੀਆ ਸੀ ਐੱਸ ਬੀ ਆਈ ਕ੍ਰੈਡਿਟ ਕਾਰਡ 'ਤੇ ਭਾਰੀ ਛੂਟ ਮਿਲ ਰਹੀ ਸੀ ਜਿਹੜਾ ਕਿ ਮੋਬਾਇਲ ਮੈਨੂੰ ਉੱਨੀ ਹਜ਼ਾਰ ਦਾ ਮਿਲਣਾ ਸੀ ਉਹ ਮੈਨੂੰ ਬਾਰਾਂ ਹਜ਼ਾਰ ਦਾ ਮਿਲਿਆ ਵਾਓ ਮੈਂ ਇੰਨੀ ਐਕਸਾਈਟਿਡ ਹੋਈ ਐਡਾ ਵਧੀਆ ਫ਼ੋਨ ਮੈਨੂੰ ਮਿਲ ਗਿਆ ਮੈਂ ਉਹ 'ਤੇ ਸਾਰਾ ਆਪਣਾ ਕੰਮ ਕਰਦੀ ਹਾਂ ਔਰ ਮੇਰਾ ਕੰਮ ਵੀ ਬਹੁਤ ਫਾਸਟ ਔਰ ਉਹਦਾ ਨੈਟ ਵੀ ਬਹੁਤ ਵਧੀਆ ਚੱਲਦਾ ਹੈ ਅਤੇ ਮੈਂ ਜਦੋਂ ਰਾਤ ਨੂੰ ਕੰਮ ਕਰਦੀ ਕਰਦੀ ਮੈਂ ਇਕਦਮ ਮੇਰੀ ਅੱਖ ਲੱਗ ਗਈ ਅਤੇ ਮੇਰੇ ਹੱਥੋਂ ਮੋਬਾਇਲ ਡਿੱਗ ਪਿਆ ਡਿੱਗਣ 'ਤੇ ਮੇਰੇ ਮਨ 'ਚ ਇੰਨਾ ਆਇਆ ਕਿ ਹਾਏ ਐ ਤਾਂ ਟੁੱਟ ਗਿਆ ਹੋਣਾ ਲੇਕਿਨ ਜਦੋਂ ਮੈਂ ਦੇਖਿਆ ਤਾਂ ਉਹਨੂੰ ਤਰੇੜ ਵੀ ਨਹੀਂ ਸੀ ਆਈ ਵਾਓ ਇੰਨਾ ਸੁੰਦਰ ਬਿਊਟੀਫੁੱਲ ਮੈਂ ਤਾਂ ਆਪਣੇ ਫਰੈਂਡ ਸਰਕਲ ਨੂੰ ਵੀ ਕਹਾਂਗੀ ਕਿ ਤੁਸੀਂ ਵੀ ਔਨਲਾਈਨ ਮੰਗਵਾਓ ਅਤੇ ਰੈੱਡਮੀ ਦਾ ਹੀ ਮੰਗਵਾਓ ਥੈਂਕਸ ਧੰਨਵਾਦ